ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਅਸੀਂ ਬਹੁਤ ਸਾਰੀ ਬਹੁਤ ਅਕਰੀਅਰ ਵਿੱਚ ਬਹੁਤ ਸਾਰੀ ਪੜ੍ਹਾਈ ਕਰ ਸਕਦੇ ਹਾਂ ਜਿਵੇਂ ਦੀ ਪੜ੍ਹਾਈ ਹੁੰਦੀ ਹੈ ਉਹਦੇ ਵਿੱਚ ਆਪਾਂ ਪਹਿਲਾਂ ਹੈ ਨਾ ਉਹਦੇ ਵਿੱਚ ਆਪਾਂ ਪਹਿਲਾਂ ਬੀ ਐੱਸਸੀ ਫਿਜ਼ਿਕਸ ਕਮਿਸਟਰੀ ਸਾਇੰਸ ਉਹਦੇ ਵਿੱਚ ਇਹ ਸਾਰੀਆਂ ਪੜ੍ਹਾਈਆਂ ਹੁੰਦੀਆਂ ਨੇ ਅਤੇ ਉਹਤੋਂ ਬਾਅਦ ਇਹਦੇ ਵਿੱਚ ਆਪਾਂ ਮਤਲਬ ਕੋਈ ਇੱਕ ਸਾਲ ਦੀ ਡਿਗਰੀ ਜੋ ਐਸਟਰੋਨਮੀ ਦੀ ਇੱਕ ਸਾਲ ਦੀ ਇਹ ਡਿਗਰੀ ਹੁੰਦੀ ਆ ਉਹਦੇ ਵਿੱਚ ਆਪਾਂ ਕਰ ਸਕਦੇ ਹਾਂ ਅਤੇ ਇਹਦੇ ਵਿੱਚ ਆਪਾਂ ਬੀ ਐੱਸਸੀ ਐੱਮ ਐੱਸਸੀ ਮਾਸਟਰਸ ਕਰਨ ਤੋਂ ਬਾਅਦ ਆਪਾਂ ਨੂੰ ਕਿਤੇ ਨਾਸਾ ਵਗੈਰਾ 'ਚ ਜੋਬ ਮਿਲ ਜਾਂਦੀ ਹੈ ਗੁਜਰਾਤ 'ਚ ਜੋਬ ਮਿਲ ਜਾਂਦੀ ਆ ਇਹਦੇ ਵਿੱਚ ਟੈਕਨੀਕਲ ਐਜੂਕੇਸ਼ਨਜ਼ ਹੁੰਦੀਆਂ ਨੇ ਜਿਵੇਂ ਇਹਦੇ ਵਿੱਚ ਆ ਗਈ ਜਿਵੇਂ ਟੈਕਨੀਕਲ ਗੁਜਰਾਤ ਯੂਨੀਵਰਸਿਟੀ ਯੂ ਐੱਸ ਡੀ ਐੱਮ ਯੂਨੀਵਰਸਿਟੀ ਇੰਡੀਅਨ ਇੰ ਇੰਸਟੀਟਿਊਟ ਆਫ ਸਾਇੰਸ ਇਨ ਬੰਗਲੌਰ ਯੂਨੀਵਰਸਿਟੀ ਇਹ ਸਾਰੀਆਂ ਯੂਨੀਵਰਸਿਟੀਆਂ ਨੇ ਇਹਦੇ ਵਿੱਚ ਆਪਾਂ ਆਪਣਾ ਤਕਨੀਕੀ ਅਤੇ ਵਿਗਿਆਨਿਕ ਸਿੱਖਿਆਵਾਂ ਲੈ ਸਕਦੇ ਹਾਂ